ਹੈਲੋ ਨਮਸਕਾਰ ਜੀ ਮੈਂ ਨਰੇਸ਼ ਬੋਲ ਰਿਹਾ ਜਿੱਦਾਂ ਕਿ ਅੱਜ ਕੱਲ੍ਹ ਮੋਦੀ ਸਰਕਾਰ ਨੇ ਸਟਰੀਮਿੰਗ ਵਗੈਰਾ ਵੀਡੀਓ ਵਗੈਰਾ 'ਤੇ ਬੜਾ ਉਹ ਕਰ ਲਿਆ ਯੂਟਿਊਬ 'ਤੇ ਬੜਾ ਵਾਇਰਲ ਹੋ ਰਹੀਆਂ ਅੱਜ ਕੱਲ੍ਹ ਸਟਰੀਮਿੰਗ ਵੀਡੀਓਜ਼ ਗੇਮਾਂ ਅੱਜ ਕੱਲ੍ਹ ਫੋਨ 'ਤੇ ਚੱਲ ਪਈਆਂ ਆਂ ਆਈ ਪੀ ਐਲ ਵਗੈਰਾ ਜਿੱਦਾਂ ਵੀ ਹੈ ਸਭ ਕੁਛ ਮੈਚ ਵਗੈਰਾ ਜੋ ਵੀ ਹੈ ਯੂਟੀਊਬ 'ਤੇ ਵੀਡੀਓ ਗੇਮਾਂ ਵਗੈਰਾ ਬੱਚੇ ਖੇਡ ਰਹੇ ਨੇ ਉਹਦੇ ਨਾਲ ਮਨੋਰੰਜਨ ਵੀ ਹੋ ਰਿਹਾ ਕਮਾਈ ਦਾ ਵੀ ਵਾਧਾ ਹੋ ਰਿਹਾ ਸਰਕਾਰ ਨੂੰ ਵੀ ਵਾਧਾ ਹੋ ਰਿਹਾ ਬਿਜਨਸ ਵੀ ਵੱਧ ਰਿਹਾ ਲਾਈਵ ਸਟਰੀਮ ਸੁਪਰਚੈਟ ਪੈਸੇ ਕਮਾਉਣ ਦਾ ਸਾਧਨ ਬਣਿਆ ਹੋਇਆ ਇਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੋ ਰਿਹਾ ਅਤੇ ਬਿਜਨਸ ਦੇ ਵਿੱਚ ਪ੍ਰੋਫਿਟ ਹੋ ਰਿਹਾ ਜਿਹੜਾ ਮਲਕੀ ਬਿਜਨਸ ਜਿਹੜਾ ਐਪ ਬਣਾ ਰਿਹਾ ਹੈ ਉਹਨੂੰ ਵੀ ਕਮਾਈ ਹੋ ਰਹੀ ਹੈ ਇਹਦੇ ਨਾਲ ਬੱਚਿਆਂ ਨੂੰ ਮਨੋਰੰਜਨ ਹੋ ਰਿਹਾ ਆ ਅੱਜ ਕੱਲ੍ਹ ਗੇਮਾਂ ਆਈ ਪੀ ਐਲ ਵਗੈਰਾ ਵੀ ਇਹਦੇ 'ਚ ਵੀ ਚੱਲ ਰਿਹਾ ਆ ਫਿਰ ਦੂਸਰੀ ਗੇਮਾਂ ਹੋਰ ਹੋ ਗਈਆਂ ਬੜੀਆਂ ਗੇਮਾਂ ਇੱਦਾਂ ਦੀਆਂ ਬਣਾ ਤੀਆਂ ਜਿਹਦੇ 'ਤੇ ਪੈਸਾ ਲਗਾ ਕੇ ਤੁਸੀਂ ਪੈਸਾ ਡਬਲ ਕਰ ਸਕਦੇ ਹੋ ਜਾਂ ਤਿੰਨ ਗੁਣਾ ਪੰਜ ਗੁਣਾ ਦਸ ਗੁਣਾ ਕਰ ਸਕਦੇ ਹੋ ਇੱਦਾਂ ਦੀਆਂ ਔਫਰਾਂ ਦੇ ਕੇ ਬੜਾ ਬਿਜਨਸ ਨੂੰ ਵਧਾ ਚੜ੍ਹਾ ਕੇ ਕਰ ਰਿਹਾ ਟਰੈਂਡਿੰਗ ਚੱਲ ਰਿਹਾ ਆ ਸਟਰੀਮਿੰਗ ਚੱਲ ਰਿਹਾ ਗੇਮਿੰਗ ਇਹੋ ਜਿਹੀਆਂ ਗੇਮਾਂ ਚੱਲ ਪਈਆਂ ਆ ਬਹੁਤ ਕੁਛ ਸਿੱਖਣ ਨੂੰ ਵੀ ਮਿਲ ਰਿਹਾ ਆ ਯੂਟੀਊਬ ਦੇ ਉੱਤੇ ਜਿੱਦਾਂ ਕੋਈ ਪਾ ਰਿਹਾ ਕਿ ਇਹ ਚੀਜ਼ ਬਣਾਓ ਇਹ ਚੀਜ਼ ਬਣਾਓ ਲੋਕਾਂ ਨੂੰ ਉਹਦੇ 'ਤੇ ਉਤਸ਼ਾਹਿਤ ਹੋ ਰਿਹਾ ਕੰਮ ਵੱਲ ਵੀ ਕੰਮ 'ਚ ਵੀ ਵਾਧਾ ਹੋ ਰਿਹਾ ਕਮਾਈ 'ਚ ਵੀ ਵਾਧਾ ਹੋ ਰਿਹਾ ਹੈ ਉਦਯੋਗ ਬਹੁਤ ਜ਼ਿਆਦਾ ਕੰਮ ਵੱਧ ਰਿਹਾ ਆ